ਮੈਂ ਅਲੱਗ ਅਲੱਗ ਜਗ੍ਹਾ 'ਤੇ ਜਾ ਕੇ ਇਹ ਕਲਾ ਪ੍ਰਦਰਸ਼ਨੀ ਦਾ ਐਕਸਪੋਜ ਦਾ ਦੌਰਾ ਬਹੁਤ ਕੀਤਾ ਇਹ ਬਹੁਤ ਵਧੀਆ ਚੀਜ਼ ਏ ਅਤੇ ਬਹੁਤ ਅੱਛਾ ਐਕਸਪੀਰੀਅਸ ਏ ਇਹ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਅਲੱਗ ਅਲੱਗ ਸ਼ਹਿਰਾਂ ਤੋਂ ਪਿੰਡਾਂ ਤੋਂ ਲੋਕ ਆਪਣੇ ਆਪਣੇ ਖੇਤਰ ਦੀਆਂ ਚੀਜ਼ਾਂ ਜਿਹੜੀਆਂ ਕਿ ਉੱਥੇ ਉਹ ਆਪਦੇ ਹੱਥ ਨਾਲ ਵੀ ਬਣਾਉਂਦੇ ਨੇ ਅਤੇ ਉਹਨਾਂ ਨੂੰ ਪ੍ਰੈਜ਼ੈਂਟ ਕਰਦੇ ਨੇ ਆਪਣੀ ਆਪਣੀ ਕਲਾ ਦਾ ਅਨੁਭਵ ਹੁੰਦਾ ਹੈ ਜਿਵੇਂ ਕਿ ਮੈਂ ਆਪਣੇ ਪ੍ਰਦਰਸ਼ਨੀ ਦੇ ਵਿੱਚ ਹੱਥ ਦਾ ਜਿਵੇਂ ਕਰੋਸ਼ੀਏ ਦਾ ਅਤੇ ਸਲਾਈਆਂ ਦਾ ਬਣਾਇਆ ਕੱਪੜੇ ਜਾਂ ਬੱਚਿਆਂ ਦੇ ਸੂਟ ਵਗੈਰਾ ਨਾ ਲੈ ਕੇ ਇਹ ਵਾਲੀ ਪ੍ਰਦਰਸ਼ਨੀ ਕੀਤੀ ਕਿ ਜਿਹਦਾ ਬਹੁਤ ਵਧੀਆ ਮੇਰਾ ਅਨੁਭਵ ਰਿਹਾ ਅਲੱਗ ਅਲੱਗ ਸ਼ਹਿਰਾਂ ਤੋਂ ਲੋਕ ਆਪਣੇ ਜੂਲਰੀ ਜੁੱਤੀ ਹੱਥ ਬੁ ਦੀ ਬਣਾਈ ਜੁੱਤੀ ਅਲੱਗ ਅਲੱਗ ਖਾਣੇ ਬਣਾਉਣੇ ਕੇਕ ਪੇਂਟਿੰਗ ਦਾ ਕਿ ਜੋ ਕਿ ਉਹ ਹੱਥ ਨਾਲ ਜਿਹੜਾ ਕੰਮ ਚਲਦਾ ਹੈ ਜਾਂ ਹੱਥ ਦੀਆਂ ਬਣੀਆਂ ਚਾਦਰਾਂ ਜਾਂ ਇਸ ਤਰ੍ਹਾਂ ਦੇ ਕਈ ਅਲੱਗ ਅਲੱਗ ਤਰ੍ਹਾਂ ਦੇ ਡਰਿੰਕਸ ਜਿਹੜੇ ਕਿ ਲਾ ਕੇ ਲੋਕ ਇਹਨਾਂ ਦਾ ਕਰਦੇ ਨੇ ਪ੍ਰਦਰਸ਼ਨੀ ਕਰਦੇ ਨੇ ਅਤੇ ਮੈਂ ਜ਼ਰੂਰ ਕਰਨਾ ਚਾਹਵਾਂਗੀ ਆਉਣ ਵਾਲੇ ਟਾਈਮ 'ਚ ਵੀ ਇਹਦਾ ਅਨੁਭਵ ਅੱਛਾ ਹੈ ਥੈਂਕ ਯੂ